ਪੇੜ ਪੌਦੇ ਲਾਉਣਾ ਸਾਡੇ ਲਈ ਬਹੁਤ ਜਰੂਰੀ ਹੁੰਦਾ ਹੈ ਕਿਉਂਕਿ ਗਰਮੀ ਜੋ ਇਸ ਤਰ੍ਹਾਂ ਵੱਧ ਰਹੀ ਹੈ ਉਹ ਉਸਦਾ ਕਾਰਨ ਵੀ ਪੇੜ ਪੋਡੇ ਪੇੜ ਪੋਦਿਆਂ ਦੀ ਘਾਟ ਹੀ ਹੈ ਸਾਨੂੰ ਪੇੜ ਪੌਦੇ ਬਹੁਤ ਸਾਰੇ ਲਾਣੇ ਚਾਹੀਦੇ ਹੈ ਇਹਨਾਂ ਪੇੜ ਪੌਦਿਆਂ ਦੀ ਸਾਨੂੰ ਦੇਖਭਾਲ ਵੀ ਕਰਨੀ ਚਾਹੀਦੀ ਹੈ ਮੌਸਮ ਦੇ ਅਨੁਕੂਲ ਸਾਨੂੰ ਇੰਨੇ ਪੌਦਿਆਂ ਦੀ ਯੋਜਨਾ ਬਣਾ ਕੇ ਇਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਗਰਮੀ ਦੇ ਮੌਸਮ ਵਿੱਚ ਅਸੀਂ ਪੌਦਾ ਪੇੜ ਪੌਦੇ ਲਾਉਂਦੇ ਹਾਂ ਤਾਂ ਇਹਨਾਂ ਪੇੜ ਪੌਦਿਆਂ ਨੂੰ ਸਾਨੂੰ ਸਮੇਂ ਸਮੇਂ 'ਤੇ ਪਾਣੀ ਅਤੇ ਖਾਦ ਦੇਣੀ ਚੋ ਚਾਹੀਦੀ ਹੈ ਸਾਨੂੰ ਆਪਦੇ ਘਰ ਦੇ ਗਿੱਲੇ ਕਚਰੇ ਯਾਨੀ ਕਿ ਜਿਵੇਂ ਕਿ ਪੱਤੀ ਪਾ ਪਾਣੀ ਵਗੈਰਾ ਸਾਨੂੰ ਉਸ ਨੂੰ ਪੌਦਿਆਂ 'ਚ ਪਾਉਣਾ ਚਾਹੀਦਾ ਹੈ ਜੋ ਕਿ ਖਾਦ ਬਣ ਜਾਂਦੀ ਹੈ ਅਤੇ ਪਸ਼ੂਆਂ ਦਾ ਜੋ ਗੋਬਰ ਹੁੰਦਾ ਹੈ ਉਹ ਵੀ ਉਸ ਨਾਲ ਵੀ ਖਾਦ ਬਣਦੀ ਹੈ ਉਹਨਾਂ ਦਾ ਵੀ ਸਾਨੂੰ ਉਪਯੋਗ ਕਰਨਾ ਕਰਨਾ ਚਾਹੀਦਾ ਹੈ ਪੇੜ ਪੌਦੇ ਹੈ ਗਰਮੀ 'ਚ ਉਸਨੂੰ ਪਾਣੀ ਦੀ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਪੇੜ ਪੌਦੇ ਨੂੰ ਪਾਣੀ ਸਵੇਰੇ ਸ਼ਾਮੀ ਬਹੁਤ ਚੰਗੀ ਤਰ੍ਹਾ ਦਿੱਤਾ ਜਾਵੇ ਇਸੇ ਤਰ੍ਹਾਂ ਦਾ ਅੰਧੇਰੀ 'ਚ ਸਾਨੂੰ ਪੇੜ ਪੌਦਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਉਹਨਾਂ ਨੂੰ ਕਿਸੇ ਕਿਸੇ ਧਾਗੇ ਦੀ ਸਪੋਰਟ ਦੇ ਕੇ ਬੰਨ੍ਹਣਾ ਚਾਹੀਦਾ ਹੈ ਤਾਂ ਜੋ ਹਨੇਰੀ ਨਾਲ ਉਹ ਡਿੱਗ ਨਾ ਪੈਣ ਅਤੇ ਉਹਨਾਂ ਦੀ ਦੀ ਦੇਖਭਾਲ ਚੰਗੀ ਤਰ੍ਹਾਂ ਹੋ ਸਕੇ ਬਾਰਿਸ਼ ਵਿੱਚ ਵੀ ਸਾਨੂੰ ਉਸ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਸਦੇ ਵਿੱਚ ਜ਼ਿਆਦਾ ਬਹੁਤ ਜ਼ਿਆਦਾ ਪਾਣੀ ਨਾ ਭਰ ਜਾਵੇ ਅਤੇ ਇਸ ਤਰ੍ਹਾਂ ਸਾਨੂੰ ਉਹ ਇਹਨਾਂ ਪੌਦਿਆਂ ਨੂੰ ਅਗਰ ਸਾਨ ਤੁਹਾਨੂੰ ਸਾਨੂੰ ਲੱਗਦਾ ਹੈ ਕਿ ਪ ਪੌਦਾ ਗਿਰ ਗਿਆ ਹੈ ਜਾਂ ਟੁੱਟ ਗਿਆ ਹੈ ਤਾਂ ਸਾਨੂੰ ਉਸਦੀ ਉਸਨੂੰ ਦੁਬਾਰਾ ਸਪੋਰਟ ਦੇ ਕੇ ਖੜ੍ਹਾ ਕਰਕੇ ਉਸਨੂੰ ਮਿੱਟੀ ਪਾ ਕੇ ਭਰ ਦੇਣਾ ਚਾਹੀਦਾ ਹੈ